ਵਿਆਹਾਂ ਵਰਗੇ ਵੱਡੇ ਸਮਾਰਾਂ ਦੌਰਾਨ ਵੱਡੀ ਮਾਤਰਾ ਦੇ ਵਿੱਚ ਪੀਣ ਵਾਲਾ ਪਾਣੀ ਜਿਹੜਾ ਹੈ ਉਹ ਤਾਂ ਅੱਜ ਕੱਲ੍ਹ ਵੱਖੋ ਵੱਖਰੀਆਂ ਕੰਪਨੀਆਂ ਨੇ ਬਹੁਤ ਪੈਕਿੰਗਾਂ ਬਣਾਈਆਂ ਹੋਈਆਂ ਹਨ ਅਤੇ ਆਪਾਂ ਜ਼ਿਆਦਾਤਰ ਵਿਆਹਾਂ ਸ਼ਾਦੀਆਂ ਦੇ ਵਿੱਚ ਉਹਨਾਂ ਪੇਟੀਆਂ ਦਾ ਹੀ ਇਸਤੇਮਾਲ ਕਰਦੇ ਹਾਂ ਔਰ ਜਾਂ ਫਿਰ ਬੋਟਲਸ ਆਉਂਦੀਆਂ ਹਨ ਪੇਟੀਆਂ ਦੇ ਵਿੱਚ ਉਹਨਾਂ ਦਾ ਇਸਤੇਮਾਲ ਕਰਦੇ ਹਾਂ ਜੇ ਗੱਲ ਕਰੀਏ ਹੋਰ ਬਾਕੀ ਜਗ੍ਹਾ 'ਤੇ ਜਾਂ ਵਾਸ਼ਰੂਮਸ ਵਗੈਰਾ ਦੇ ਵਿੱਚ ਜਾਂ ਹੱਥ ਧੋਣ ਦੇ ਲਈ ਉਹ ਤਾਂ ਜ਼ਿਆਦਾਤਰ ਜਿਹੜੇ ਪੈਲਸ ਨੇ ਉਹਨਾਂ ਦੇ ਵਿੱਚ ਅੱਜ ਕੱਲ੍ਹ ਸਮਰਸੀਬਲ ਦੀ ਉਪ ਹੈਗੇ ਆ ਲੱਗੇ ਹੋਏ ਨੇ ਉਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਜੇ ਕਿਤੇ ਜਗ੍ਹਾ 'ਤੇ ਕਿੱਲਤ ਹੈ ਪਾਣੀ ਦੀ ਸਮਰਸੀਬਲ ਵੀ ਨਹੀਂ ਹੈ ਤਾਂ ਉੱਥੇ ਪਾਣੀ ਦੇ ਟੈਂਕ ਵਗੈਰਾ ਦਾ ਪ੍ਰਯੋਗ ਕਰ ਲਿੱਤਾ ਜਾਂਦਾ ਹੈ ਜੇ ਕਿਸੇ ਨੇ ਖੁੱਲ੍ਹੇ ਮੈਦਾਨ ਦੇ ਵਿੱਚ ਕੋਈ ਫੰਕਸ਼ਨ ਕੀਤਾ ਹੋਵੇ ਅਤੇ ਮਤਲਬ ਪਾਣੀ ਦੀ ਦਿੱਕਤ ਵਿਆਹਾਂ ਸ਼ਾਦੀਆਂ ਦੇ ਵਿੱਚ ਕਦੀ ਆਉਂਦੀ ਨਹੀਂ ਅੱਜ ਕੱਲ੍ਹ ਕਿਉਂਕਿ ਨਵੀਆਂ ਕਾਢਾਂ ਨੇ ਅਤੇ ਨਵੀਆਂ ਚੀਜ਼ਾਂ ਆ ਚੁੱਕੀਆਂ ਨੇ ਜਿਹਦੇ ਕਰਕੇ ਅੱਜ ਕੱਲ੍ਹ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਚੀਜ਼ ਦੀ ਕਮੀ ਮਤਲਬ ਹੁੰਦੀ ਨਹੀਂ ਆ ਇਨਸਾਨ ਨੂੰ ਤੋ ਪਾਣੀ ਜਿਹੜੀ ਚੀਜ਼ ਹੈ ਉਹ ਤਾਂ ਵਿਆਵਾਂ ਸ਼ਾਦੀਆਂ 'ਚ ਵੈਸੇ ਹੀ ਬਹੁਤ ਲੋੜੀਂਦਾ ਚੀਜ਼ ਹੈ ਜਿਸ ਤੋਂ ਬਿਨਾਂ ਤਾਂ ਜੇਕਰ ਵਿਆਹ ਸ਼ਾਦੀ ਕਿਸੇ ਦੇ ਵਿੱਚ ਪਾਣੀ ਨਾ ਮਿਲੇ ਇਨਸਾਨ ਨੂੰ ਪੀਣ ਦੇ ਲਈ ਤੇ ਉਸ ਵਿਆਹ ਨੂੰ ਲੋਕ ਜਾਣ ਲੱਗਿਆਂ ਆਪਣੇ ਆਪ ਤੇ ਕੀ ਕਹਿੰਦੇ ਘਰ ਜਾ ਕੇ ਕੀ ਗੱਲਾਂ ਕਰਨੀਆਂ ਉੱਥੇ ਹੀ ਸ਼ੁਰੂ ਹੋ ਜਾਂਦੇ ਲੈ ਜੀ ਇਹ ਹੋ ਗਿਆ ਉਹ ਹੋ ਗਿਆ ਤੋ ਪਾਣੀ ਬੜੀ ਜਰੂਰੀ ਚੀਜ਼ ਹੈ ਇਸ ਕਰਕੇ ਪਾਣੀ ਦੀ ਵਰਤੋਂ ਜ਼ਿਆਦਾਤਰ ਅਸੀਂ ਪੇਟੀਆਂ ਮੰਗਵਾ ਕੇ ਜਾਂ ਫਿਰ ਟੈਂਕਰ ਵਗੈਰਾ ਔਰ ਇਹਨਾਂ ਚੀਜ਼ਾਂ ਦਾ ਸਹਾਰਾ ਲੈ ਕੇ ਹੀ ਕਰਦੇ ਹਾਂ